ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਹਾਂਜੀ ਕੋਈ ਗੱਲ ਨਹੀਂ ਤੁਸੀਂ ਸਾਨੂੰ ਦੱਸ ਦਓ ਮਿਲ ਪਓ ਵੀ ਕਿੱਥੇ ਮਿਲਣਾ ਤੁਸੀਂ ਅਤੇ ਫਿਰ ਅਸੀਂ ਕਰ ਲੈਂਦੇ ਹਾਂ ਕੋਈ ਗੱਲ ਨਹੀਂ ਹਾਂਜੀ ਤੁਸੀਂ ਮੈਨੂੰ ਆਪਣਾ ਅਡਰੈੱਸ ਭੇਜ ਦਿਓ ਨਾ ਅਤੇ ਅਸੀਂ ਮੈਂ ਤੁਹਾਨੂੰ ਮਿਲ ਲਵਾਂਗੀ ਹਾਂਜੀ ਚਲੋ ਠੀਕ ਆ ਓਕੇ ਬਾਏ